ਹੈਲੋ ਹਾਂਜੀ ਕੌਣ ਹਾਂਜੀ ਹਾਂਜੀ ਹਾਂਜੀ ਦੱਸੋ ਸਰ ਅੱਛਾ ਹਾਂਜੀ ਅੱਛਾ ਅੱਛਾ ਅੱਛਾ ਅੱਛਾ ਅੱਛਾ ਹਾਂਜੀ ਹਾਂਜੀ ਠੀਕ ਹੈ ਜੀ ਹ ਹਾਂਜੀ ਹਾਾਂਜੀ ਪੀਪਲ ਐਂਡ ਪਲੇਸਿਸ ਵੀ ਬਹੁਤ ਆ ਇੱਥੇ ਦੇਖਣ ਲਈ ਜਿਵੇਂ ਆਊਟਲੈਟ ਆ ਵੀ ਬਹੁਤ ਹੋਟਲ ਆ ਵੀ ਇੱਦਾਂ ਦੀਪਕ ਢਾਬਾ ਹੋਟਲ ਅੱਛਾ ਤੁਸੀਂ ਅੱਛਾ ਪੀਪਲ ਬਾਰੇ ਕਰ ਰਹੇ ਹੋ ਠੀਕ ਹੈ ਅੱਛਾ ਅੱਛਾ ਲੋਕਾਂ ਬਾਰੇ ਠੀਕ ਹੈ ਹਾਂਜੀ ਸਭ ਤੋਂ ਫੇਮਸ ਬਰਨਾਲੇ 'ਚ ਸੁਰਜੀ ਸੁਰਜੀਤ ਸਿੰਘ ਹਾਂਜੀ ਇਹ ਸੀ ਐਮ ਰਹੇ ਆ ਬਰਨਾਲੇ 'ਚ ਸੀ ਐਮ ਸੀ ਇਹਨਾਂ ਦੀ ਡੈਥ ਹੋ ਗਈ ਹਾਂਜੀ ਅਤੇ ਇਹਨਾਂ ਦੀ ਹਾਂਜੀ ਹਾਂਜੀ ਹਾਂ ਹਾਂ ਹਾਂ ਉਹਨਾਂ ਬਾਰੇ ਹੀ ਕਹਿ ਰਹੀ ਹਾਂ ਬਹੁਤ ਮਸ਼ਹੂਰ ਸੀਗੇ ਹਾਂਜੀ ਹਾਂਜੀ ਬਰਨਾਲਾ ਦੇ ਹੀ ਸੀਗੇ ਅਤੇ ਹੋਰ ਕੇਬਲ ਢਿੱਲੋਂ ਆ ਬੀ ਜੇ ਪੀ ਦੇ ਹਾਂਜੀ ਵੀ ਬਹੁਤ ਵਧੀਆ ਹਾਂਜੀ ਹਾਂਜੀ ਇਹਨਾਂ ਦੇ ਲੀਡਰ ਹੈਗੇ ਅਤੇ ਮੀਤ ਹੇਅਰ ਬਹੁਤ ਵਧੀਆ ਇਨਸਾਨ ਆ ਉਹਨਾਂ ਨੇ ਐਮ ਐਲ ਏ ਰਹੇ ਆ ਪਹਿਲਾਂ ਫਿਰ ਮੰਤਰੀ ਹੁਣ ਐਮ ਪੀ ਹਾਂਜੀ ਪਹਿਲੇ ਐਮ ਪੀ ਆ ਹਾਂਜੀ ਬਹੁਤ ਹੀ ਨਾਈਸ ਉਹਨਾਂ ਦਾ ਨੇਚਰ ਆ ਹਾਂਜੀ ਜੇ ਤੁਸੀਂ ਮਿਲਣਾ ਇਹਨਾਂ ਬਾਰੇ ਅਤੇ ਅਤੇ ਅ ਹਾਂ ਆਮ ਆਦਮੀ ਪਾਰਟੀ ਨਾਲ ਰਿਲੇਟਡ ਹਾਂਜੀ ਅਤੇ ਇਹਨਾਂ ਨੂੰ ਜਦੋਂ ਵੀ ਮਿਲਣਾ ਕਦੇ ਵੀ ਘਰ ਚਲੇ ਜਾਓ ਕਾਲ ਕਰਕੇ ਕਦੇ ਨਹੀਂ ਉਹ ਕਰ ਰਹੇ ਇਹ ਬਹੁਤ ਵਧੀਆ ਸਾਰਿਆਂ ਨਾਲ ਬੀਹੇਵ ਕਰਦੇ ਆ ਮਿਲਦੇ ਆ ਹਾਂਜੀ ਅਤੇ ਸਟੈਂਡਰਡ ਕੰਬਾਈਨ ਵਾਲੇ ਆ ਹਾਂਜੀ ਇਹਨਾਂ ਦੀ ਆਲ ਇੰਡੀਆ 'ਚ ਸਾਰੀ ਕੰਬਾਈਨ ਮਸ਼ਹੂਰ ਆ ਕੰਬਾਈਨ ਹਾਂਜੀ ਹਾਂਜੀ ਹੋਰ ਬਰ ਬਲਕਾਰ ਕੰਬਾਈਨ ਵਾਲੇ ਆ ਇੰਦਰ ਸਿੰਘ ਇਹ ਵੀ ਬਹੁਤ ਵਧੀਆ ਹਾਂਜੀ ਇਨਸਾਨ ਆ ਕਦੋਂ ਵੀ ਤੁਸੀਂ ਮਿਲਣਾ ਹੋਵੇ ਹਾਂਜੀ ਇੱਕ ਓਮ ਪ੍ਰਕਾਸ਼ ਆ ਜੀ ਇਹਨਾਂ ਨੇ ਨਾਵਲ ਲਿਖੇ ਆ ਜੀ ਲੇਖਕ ਆ ਇਹ ਹਾਂਜੀ ਹਾਂਜੀ ਔਰ ਬਰਨਾਲੇ ਤੋਂ ਹੀ ਆ ਹਾਂਜੀ ਅਤੇ ਸਿੰਗਰ ਵੀ ਰਹੇ ਆ ਬਰਨਾਲਾ 'ਚ ਜੀ ਖੇ ਖਾ ਜੀ ਖਾਨ ਅਰਜਨ ਢਿੱਲੋਂ ਹਾਂਜੀ ਇਹਨਾਂ ਨੇ ਬਹੁਤ ਹਾਂ ਬਰਨਾਲਾ ਦੇ ਹੀ ਆ ਵ ਇੱਥੇ ਰਹਿੰਦੇ ਆ ਕਦੋਂ ਵੀ ਤੁਸੀਂ ਮਿਲਣਾ ਹੋਵੇ ਆ ਸਕਦੇ ਹੋ ਉਹਨਾਂ ਨੂੰ ਮਿਲਣ ਅਰਜਨ ਢਿੱਲੋਂ ਇੰਦਰ ਸਿੰਘ ਹਾਂਜੀ ਬਰਨਾਲਾ 'ਚ ਬਹੁਤ ਹੀ ਮਹਾਨ ਹਸਤੀਆਂ ਰਹਿੰਦੇ ਆਗੇ ਜਿੱਦਾਂ ਸੁਰਜੀਤ ਬਰਨਾਲਾ ਬਾਰੇ ਤੁਹਾਨੂੰ ਦੱਸਤਾ ਮੀਤ ਹੇਅਰ ਹੋ ਗਿਆ ਹਾਂਜੀ ਤੁਸੀਂ ਇਹ ਹਾਂ ਹਾਂਜੀ ਹਾਂਜੀ ਹਾਂਜੀ ਤੁਸੀਂ ਕਿਸੇ ਬਾਰੇ ਵੀ ਦੱਸਣਾ ਹੋਵੇ ਪੁੱਛਣਾ ਹੋਵੇ ਕੋਈ ਗੱਲ ਨਹੀਂ ਮੈਂ ਤੁਹਾਨੂੰ ਦੱਸ ਸਕਦੀ ਹਾਂ ਜਦੋਂ ਮਰਜ਼ੀ ਤੁਸੀਂ ਪੁੱਛ ਸਕਦੇ ਹੋ ਇਹਨਾਂ ਦੀ ਡਿਟੇਲ ਬਾਰੇ ਅੱਛਾ ਠੀਕ ਹੈ ਟਰਾਈਡੈਂਟ ਹਾਂਜੀ ਟਰਾਈਡੈਂਟ ਕੰਪਨੀ ਦੇ ਮਾਲਕ ਵੀ ਇੱਧਰ ਆ ਗਏ ਹਾਂਜੀ ਰਜਿੰਦਰ ਰਜਿੰਦਰ ਗੁਪਤਾ ਜੀ ਉਹ ਵੀ ਬਹੁਤ ਵਧੀਆ ਇਨਸਾਨ ਜਦੋਂ ਕਦੇ ਵੀ ਤੁਸੀਂ ਉਹਨਾਂ ਨੂੰ ਮਿਲਣਾ ਹੋਵੇ ਤੁਸੀਂ ਆ ਸਕਦੇ ਹੋ ਇੱਧਰ ਮੈਨੂੰ ਕੌਲ ਕਰ ਦਿਉ ਹਾਂਜੀ ਹਾਂਜੀ ਠੀਕ ਹੈ ਠੀਕ ਆ ਠੀਕ ਆ ਹਾਂਜੀ ਠੀਕ ਆ ਜੀ ਓਕੇ ਓਕੇ